ਮੇਰੀ ਮਨਪਸੰਦ ਲੇਖਕ ਅੰਮ੍ਰਿਤਾ ਪ੍ਰੀਤਮ ਜਿਹਨਾਂ ਦਾ ਜਨਮ ਇਕੱਤੀ ਅਗਸਤ ਉੱਨੀ ਸੌ ਉੱਨੀ ਨੂੰ ਗੁਜਰਾਂਵਾਲਾ ਪਾਕਿਸਤਾਨ ਵਿੱਚ ਹੋਇਆ ਸੀਗਾ ਉਹਨਾਂ ਨੇ ਆਪਣੇ ਜੀਵਨ ਵਿੱਚ ਲਗਭਗ ਸੌ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚ ਉਹਨਾਂ ਦੀ ਆਤਮ ਕਥਾ ਰਸੀਦੀ ਟਿਕਟ ਨੂੰ ਕਾਫੀ ਸਤਿਕਾਰ ਮਿਲਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਜੀਵਨ ਦੀ ਹਰ ਗੱਲ ਨੂੰ ਸਾਂਝਿਆ ਕੀਤਾ ਅੰਮ੍ਰਿਤਾ ਪ੍ਰੀਤਮ ਦੀ ਲਿਖਣੀ ਕਾਫੀ ਸੁਲਝੀ ਹੋਈ ਸੀ ਅਤੇ ਉਹਨਾਂ ਦੇ ਵਿਚਾਰ ਕਾਫੀ ਅਗਾਂਹ ਵਧੂ ਸਨ ਜਿਨ੍ਹਾਂ ਨੂੰ ਦੇਖ ਕੇ ਸਾਰੇ ਲੋਕ ਪ੍ਰਭਾਵਿਤ ਹੋ ਜਾਂਦੇ ਸੀ ਅਤੇ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਕਾਫੀ ਗਿਆਨ ਮਿਲਦਾ ਸੀਗਾ ਉਹਨਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਦੂਸਰੇ ਇਨਾਮ ਪਦਮ ਅ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਮੌਤ ਦੋ ਹਜ਼ਾਰ ਪੰਜ ਵਿੱਚ ਛਿਆਸੀ ਸਾਲ ਦੀ ਉਮਰ ਵਿੱਚ ਹੋ ਗਈ ਜਿਸ ਨਾਲ ਪੰਜਾਬ ਅਤੇ ਪੰਜਾਬੀ ਦੇ ਲੇਖਕਾਂ ਦਾ ਘਾਟਾ ਸਾਰੇ ਪੜ੍ਹਨ ਵਾਲਿਆਂ ਨੂੰ ਕਾਫੀ ਜੋਰਦਾਰ ਲੱਗਿਆ